ਪਿਛਲੇ ਇੱਕ ਹਫ਼ਤੇ ਪਹਿਲਾਂ ਹੀ ਅਸੀਂ ਆਪਣਾ ਪਿੰਡ ਦੇ ਵਿੱਚ ਇੱਕ ਕੱਪੜੇ ਦਾ ਵਪਾਰ ਸ਼ੁਰੂ ਕੀਤਾ ਜਿਸ ਵਿੱਚ ਆਪਾਂ ਹਰ ਤਰ੍ਹਾਂ ਦਾ ਕੱਪੜਾ ਥੋਕ ਵੀ ਅਤੇ ਪਰਚੂਨ ਵੀ ਅਸੀਂ ਉੱਥੇ ਸਮਾਨ ਉਪਲੱਬਧ ਕਰਵਾਇਆ ਬੱਚਿਆਂ ਦੇ ਕੱਪੜਿਆਂ ਤੋਂ ਲੈ ਕੇ ਵੱਡਿਆਂ ਦੇ ਕੱਪੜਿਆਂ ਤੱਕ ਅਸੀਂ ਆਪਣਾ ਕਾਰੋਬਾਰ ਕੱਪੜੇ ਦਾ ਸ਼ੁਰੂ ਕੀਤਾ ਉਸ ਵਿੱਚ ਸਾਡੀ ਲੋਕਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਇੱਕ ਹਫ਼ਤਾ ਹੀ ਹੋਇਆ ਸੀ ਸਾਡੀ ਸਾਡਾ ਕੱਪੜੇ ਦਾ ਕਾਰੋਬਾਰ ਸ਼ੁਰੂ ਹੋਣ 'ਤੇ ਕਿ ਲੋਕਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਅਤੇ ਲੋਕ ਆਲੇ ਦੁਆਲੇ ਪਿੰਡਾਂ ਤੋਂ ਵੀ ਇੱਕ ਦੂਜੇ ਨੂੰ ਕਹਿ ਕਵਾ ਕੇ ਸਾਡੇ ਕੋਲ ਖਰੀਦਦਾਰੀ ਕਰਨ ਆਉਂਦੇ ਹਨ ਜੋ ਲੋਕ ਪਿੰਡਾਂ ਤੋਂ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾ ਕੇ ਮੌਲਾਂ 'ਚ ਜਾ ਕੇ ਕੱਪੜੇ ਲੈਂਦੇ ਸਨ ਤਾਂ ਉਹਨਾਂ ਨੂੰ ਉਹ ਦੂਰ ਜਾਣਾ ਪੈਂਦਾ ਸੀ ਪਰ ਹੁਣ ਅਸੀਂ ਆਪਣਾ ਕੱਪੜੇ ਦਾ ਇੱਥੇ ਬਹੁਤ ਵੱਡਾ ਪਿੰਡ ਵਿੱਚ ਸ਼ੋਰੂਮ ਜਿਹਾ ਖੋਲ ਲਿਆ ਹੈ ਤਾਂ ਲੋਕਾਂ ਨੂੰ ਸ਼ਹਿਰ ਜਾਣ ਦੀ ਵੀ ਲੋੜ ਨਹੀਂ ਪੈਂਦੀ ਤਾਂ ਉਹ ਸਾਡੀ ਦੁਕਾਨ 'ਤੇ ਆ ਕੇ ਸ਼ੋਪਿੰਗ ਕਰਦੇ ਹਨ ਅਤੇ ਅਤੇ ਉਨ੍ਹਾਂ ਨੂੰ ਆਪਾਂ ਇੱਕ ਸੂਟ ਦੇ ਨਾਲ ਇੱਕ ਬੱਚੇ ਦਾ ਸੂਟ ਗਿਫਟ ਵੀ ਕਰਦੇ ਹਨ ਜਿਸ ਨਾਲ ਕਿ ਸਾਨੂੰ ਬਹੁਤ ਹੀ ਸਫਲਤਾ ਪੂਰਵਕ ਸਾਡਾ ਕਾਰੋਬਾਰ ਸ਼ੁਰੂ ਹੋ ਗਿਆ ਹੈ